ਰੰਗੋਲੀ ਦਿਵਾਲੀ ਦੇ ਤਿਉਹਾਰ 'ਤੇ ਬਣਾਈ ਜਾਂਦੀ ਹੈ ਰੰਗੋਲੀ ਛੋਟੀਆਂ ਕੁੜੀਆਂ ਬਣਾਉਂਦੀਆਂ ਹਨ ਛੋਟੀਆਂ ਜਾਂ ਵੱਡੀਆਂ ਕੁੜੀਆਂ ਵੀ ਬਣਾ ਲੈਦੀਆਂ ਹਨ ਅਤੇ ਇਸ ਵਿੱਚ ਕੁੜੀਆਂ ਆਪਣੀ ਕਲਾ ਕਿਰਤੀਆਂ ਨੂੰ ਦਰਸਾਉਂਦੀਆਂ ਹਨ ਸੂਰਜ ਨੂੰ ਪਾਣੀ ਚੜ੍ਹਾਉਣਾ ਮੱਥੇ 'ਤੇ ਸੰਦੂਰ ਇਹ ਸਾਰਾ ਇਹ ਸਭ ਕੁਝ ਹਿੰਦੂ ਧਰਮ ਵਿੱਚ ਹੁੰਦਾ ਹੈ ਪਵਿੱਤਰ ਧਾਗਾ ਪਾਉਣਾ ਇਹ ਵੀ ਹਿੰਦੂ ਧਰਮ ਦੇ ਹੀ ਨਿਸ਼ਾਨੀ ਹੈ ਪੂਜਾ ਲਈ ਮੰਦਰ ਜਾਣਾ ਅਸ ਪਰ ਅਸ ਅਸੀਂ ਸਾਡੇ ਧਰਮ ਵਿੱਚ ਅਸੀਂ ਗੁਰਦੁਆਰੇ ਮੱਥਾ ਟੇਕਦੇ ਹਾਂ ਪੂਜਾ ਲਈ ਮੰਦਰ ਨਹੀਂ ਜਾਂਦੇ ਦਰਗਾਹ 'ਤੇ ਜਾਣਾ ਵਰਤ ਰੋਜ਼ੇ ਇਹ ਸਭ ਕੁਝ ਮੁਸਲਮਾਨ ਕਰਦੇ ਹਨ ਮੁਸਲਮਾਨ ਦਰਗਾਹ 'ਤੇ ਜਾਣਾ ਪਸੰਦ ਕਰਦੇ ਹਨ ਅਤੇ ਉਹ ਹੀ ਰੋਜ਼ੇ ਰੱਖਦੇ ਹਨ ਪਰ ਸਾਡੇ ਧਰਮ ਵਿੱਚ ਸਭ ਨੂੰ ਇੱਕ ਸਮਾਨਤਾ ਦਿੱਤੀ ਗਈ ਸਮਾ ਸਨਮਾਨ ਦਿੱਤਾ ਗਿਆ ਹੈ ਮਰਦ ਅਤੇ ਔਰਤ ਦੋਨਾਂ ਨੂੰ ਬਰਾਬਰ ਰੱਖਿਆ ਗਿਆ ਹੈ